ਹਾਂ ਹਾਂਜੀ ਮਤਲਬ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਜਿਹੜੀ ਹੈ ਅੱਜ ਕੱਲ੍ਹ ਬਾਲਣ ਦੇ ਤੌਰ 'ਤੇ ਬਹੁਤ ਜ਼ਿਆਦਾ ਵ ਮਤਲਬ ਯੂਜ ਹੋ ਰਹੀ ਹੈ ਪਹਿਲਾਂ ਦੇ ਟਾਈਮ 'ਚ ਆਪਾਂ ਘਰਾਂ 'ਚ ਆਮ ਜਿਵੇਂ ਬਾਲਣ ਲੱਕੜੀ ਕੋਲਾ ਵਗੈਰਾ ਇਸਤੇਮਾਲ ਕਰਦੇ ਹੁੰਦੇ ਸੀ ਪਰ ਅੱਜ ਕੱਲ੍ਹ ਐੱਲ ਪੀ ਜੀ ਸਿਲੰਡਰ ਦੀ ਹੀ ਵਰਤੋਂ ਹੋ ਰਹੀ ਹੈ ਕਿਉਂਕਿ ਇਹ ਮਤਲਬ ਇਹਦੀ ਸਹੂਲੀਅਤ ਬਹੁਤ ਹੈ ਲੋਕਾਂ ਨੂੰ ਮਤਲਬ ਇਹ ਇੱਕ ਤਾਂ ਅੱਜ ਕੱਲ੍ਹ ਇਜ਼ੀਲੀ ਅਵੇਲੇਬਲ ਹੋ ਜਾਂਦਾ ਅਤੇ ਮਤਲਬ ਇਹ ਯੂਜ਼ ਕਰਨਾ ਵੀ ਬਹੁਤ ਅਸਾਨ ਹੈ ਪਰ ਇਹਦੇ ਨਾਲ ਕੁਛ ਇਹਦੀਆਂ ਮਤਲਬ ਕੁਛ ਮਤਲਬ ਇਹਦੇ ਨੁਕਸਾਨ ਵੀ ਹੈ ਜਾਂ ਆਪਾਂ ਕਹਿ ਦੇਈਏ ਕਿ ਅ ਇਹਨੂੰ ਥੋੜ੍ਹਾ ਜਿਹਾ ਸਾਵਧਾਨੀ ਨਾਲ ਵਰਤਣਾ ਵੀ ਪੈਂਦਾ ਇਹਦੇ ਲਈ ਆਪਾਂ ਨੂੰ ਇੱਕ ਤਾਂ ਮਤਲਬ ਚੈੱਕ ਕਰਕੇ ਸਿਲੰਡਰ ਲੈਣਾ ਚਾਹੀਦਾ ਕਿ ਉਹ ਲੀਕ ਤਾਂ ਨਹੀਂ ਹੋ ਰਿਹਾ ਜਦੋਂ ਵੀ ਆਪਾਂ ਸਿਲੰਡਰ ਲੈਂਦੇ ਹਾਂ ਅਤੇ ਜਦੋਂ ਆਪਾਂ ਘਰ ਹੀ ਸਿਲੰਡਰ ਲਗਾਉਂਦੇ ਹਾਂ ਤਾਂ ਇਹ ਤੁਸੀਂ ਮਤਲਬ ਚੈੱਕ ਕਰ ਲਓ ਕਿ ਜਦੋਂ ਤੁਸੀਂ ਸਿਲੰਡਰ ਲਗਾਇਆ ਉਹਦਾ ਜਿਹੜਾ ਰੈਗੂਲੇਟਰ ਵਗੈਰਾ ਉਹ ਅੱਛੀ ਤਰ੍ਹਾਂ ਫਿਕਸ ਹੋ ਗਿਆ ਹੋਵੇ ਮਤਲਬ ਕੋਈ ਘਰ 'ਚ ਜਿਹੜਾ ਐਕਸਪੀਰੀਐਂਸ ਬੰਦਾ ਉਹ ਹੀ ਮਤਲਬ ਉਹਨੂੰ ਲਗਾਵੇ ਸਿਲੰਡਰ ਵਗੈਰਾ ਜਿਹੜਾ ਆਪਾਂ ਫਿਕਸ ਕਰਦੇ ਹਾਂ ਆਪਣੇ ਸਟੋਵ ਦੇ ਨਾਲ ਅਤੇ ਕਦੇ ਵੀ ਜਦੋਂ ਆਪਾਂ ਯੂਜ਼ ਕਰਦੇ ਹਾਂ ਇਹਨੂੰ ਤਾਂ ਮਤਲਬ ਚੈੱਕ ਕਰ ਲੈਣਾ ਚਾਹੀਦਾ ਕਿ ਆਪਾਂ ਕਈ ਵਰੀ ਇਹਨੂੰ ਓਨ ਕਰਕੇ ਛੱਡ ਦਿੰਦੇ ਹਾਂ ਅਤੇ ਕੁਛ ਲੱਭਣ ਲੱਗ ਜਾਂਦੇ ਹਾਂ ਤਾਂ ਫਿਰ ਇਹ ਇਹਦੀ ਜਿਹੜੀ ਗੈਸ ਉਹ ਫੈਲ ਜਾਂਦੀ ਹੈ ਸਾਰੇ ਮਤਲਬ ਰੁ ਅ ਕਿਚਨ 'ਚ ਅਤੇ ਆਪਾਂ ਕੁਛ ਉਸ ਟਾਈਮ ਜੇ ਕੁਛ ਚਲਾ ਦੇਈਏ ਲਾਈਟ ਵੀ ਚਲਾ ਦੇਈਏ ਤਾਂ ਵੀ ਇਹਦੇ 'ਚ ਬਲਾਸਟ ਹੋ ਸਕਦਾ ਜਾਂ ਪਾਈਪ ਵਗੈਰਾ ਜਿਹੜੀ ਇਹਦੀ ਜਿਹਦੇ ਨਾਲ ਗੈਸ ਜਾਂਦੀ ਹੈ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਲੀਕ ਨਾ ਕਰ ਰਹੀ ਹੋਵੇ ਉਹਦੇ 'ਚ ਕੋਈ ਕੋਈ ਮਤਲਬ ਅੱਛੀ ਕੁਆਲਟੀ ਦੀ ਹੋਣੀ ਚਾਹੀਦੀ ਹੈ ਪਾਈਪ ਜਿਹੜੀ ਲਗਾਉਣੀ ਹੈ ਅਤੇ ਬੱਚਿਆਂ ਦੀ ਪਹੁੰਚ ਤੋਂ ਬੜਾ ਦੂਰ ਹੋਣਾ ਚਾਹੀਦਾ ਤਾਂ ਕਿ ਬੱਚੇ ਉਹਦਾ ਜਿਹੜਾ ਰੈਗੂਲੇਟਰ ਹੈਗਾ ਜਿਹੜਾ ਉਹ ਓਨ ਨਾ ਕਰ ਦੇਣ ਤਾਂ ਇਹਨੂੰ ਬੜਾ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ਧੰਨਵਾਦ